ਅਟਲ ਅੰਮ੍ਰਿਤ ਯੋਜਨਾ ਅਸਾਮ ਸਰਕਾਰ ਦੀ ਇੱਕ ਪ੍ਰਮੁੱਖ ਯੋਜਨਾ ਹੈ ਜਿਸ ਦਾ ਉਦੇਸ਼ ਗਰੀਬ ਲੋਕਾਂ ਨੂੰ ਜਿਹੜੇ ਗਰੀਬੀ ਰੇਖਾ ਤੋਂ ਥੱਲੇ ਰਹਿੰਦੇ ਹਨ ਉਹਨਾਂ ਨੂੰ ਉਹਨਾਂ ਪਰਿਵਾਰਾਂ ਨੂੰ ਲਕਸ਼ਿਤ ਕਰਨ ਲਈ ਕੈਸ਼ਲੈਸ ਉਪਚਾਰ ਅਤੇ ਮਹੱਤਵਪੂਰਨ ਦੇਖਭਾਲ ਦਾ ਕਵਰੇਜ ਪ੍ਰਦਾਨ ਕਰਦੇ ਹਨ ਇਹਦੇ ਨਾਲ ਗਰੀਬ ਲੋਕ ਜਿਹਨਾਂ ਕੋਲ ਰਹਿਣ ਸਹਿਣ ਦਾ ਔਖ ਹੁੰਦਾ ਹੈ ਉਹ ਥੋੜ੍ਹੀ ਸੌਖੀ ਜ਼ਿੰਦਗੀ ਜਿਊਂਦੇ ਹਨ